ਮੈਂ ਪੰਜਾਬ ਦਾ ਰਹਿਣ ਵਾਲਾ ਹਾਂ ਪੰਜਾਬ ਦੇ ਵਿੱਚ ਮੈਂ ਮਾਨਸਾ ਡਿਸਟਰਿਕਟ ਵਿੱਚ ਰਹਿੰਦਾ ਮੈਂ ਸੋਨੂ ਲੋਕ ਗੀਤਾਂ ਬਾਰੇ ਕੁਝ ਸਮਾਚਾਰ ਦੇਣਾ ਚਾਹੁੰਦਾ ਹਾਂ ਲੋਕ ਗੀਤ ਲੋਕਾਂ ਦੁਆਰਾ ਕਰੇ ਤਮਾਸ਼ੇ ਪਾਏ ਗਿੱਧੇ ਜਾਂ ਉਹਨਾਂ ਦੁਆਰਾ ਗਾਏ ਗੀਤ ਉਹਨਾਂ ਨੂੰ ਹੀ ਆਪਾਂ ਲੋਕ ਗੀਤ ਕਹਿੰਦੇ ਹਾਂ ਪੁਰਾਣੇ ਜ਼ਮਾਨੇ ਵਿੱਚ ਲੋਕ ਗੀਤਾਂ ਦੀ ਬਹੁਤ ਜ਼ਿਆਦਾ ਮਹੱਤਤਾ ਸੀ ਪਰ ਅੱਜ ਵਾਲੇ ਜ਼ਮਾਨੇ ਵਿੱਚ ਇਹ ਮਹੱਤਤਾ ਘੱਟ ਗਈ ਹੈ ਪੁਰਾਣੇ ਜ਼ਮਾਨੇ ਵਿੱਚ ਜਦੋਂ ਕਿਸੇ ਘਰ ਮੁੰਡਾ ਹੁੰਦਾ ਤਾਂ ਲੋਕ ਰਾਗ ਗਾਉਂਦੇ ਕਿਸੇ ਘਰ ਕੋਈ ਬੰਦਾ ਮਰਦਾ ਤਾਂ ਬੁੜੀਆਂ ਵੈਣ ਪਾਉਣ ਲੱਗ ਜਾਂਦੀਆਂ ਪਰ ਇਹ ਪ੍ਰਥਾ ਅੱਜ ਵੀ ਕਾਇਮ ਹੈ ਪਰ ਜੋ ਪੁਰਾਣੇ ਲੋਕ ਗੀਤ ਹਨ ਉਹਨਾਂ ਦੀ ਮਹੱਤਤਾ ਅੱਜ ਦੇ ਜ਼ਮਾਨੇ ਵਿੱਚ ਬਹੁਤ ਜ਼ਿਆਦਾ ਘੱਟ ਚੁੱਕੀ ਹੈ ਅੱਜ ਦੇ ਜ਼ਮਾਨੇ ਵਿੱਚ ਬੋਲੀਵੁੱਡ ਗਾਣੇ ਆ ਗਏ ਹਿੰਦੀ ਗਾਣੇ ਆ ਗਏ ਠੀਕ ਹੈ ਮਰਾਠੀ ਗਾਣੇ ਆ ਗਏ ਲੋਕ ਲੋਕ ਗੀਤਾਂ ਨੂੰ ਛੱਡ ਕੇ ਉਹਨਾਂ ਗਾਣਿਆਂ ਵੱਲ ਭੱਜਦੇ ਨੇ ਪਹਿਲਾਂ ਵਾਲੇ ਜ਼ਮਾਨੇ ਦੇ ਵਿੱਚ ਬਹੁਤ ਤਰ੍ਹਾਂ ਦੇ ਲੋਕ ਗੀਤ ਗਾਏ ਜਾਂਦੇ ਸਨ ਜਿਵੇਂ ਕਿ ਮਾਂ ਹੁੰਦੀ ਹੈ ਮਾਂ ਦੁਨੀਆਂ ਵਾਲੇ ਇਹ ਇੱਕ ਲੋਕ ਗੀਤ ਹੈ ਦੂਸਰਾ ਲੋਕ ਗੀਤ ਹੈ ਨਾਨਕ ਨਾਮੁ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਨਾਨਕ ਨਾਮੁ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭ ਇਹ ਵੀ ਇੱਕ ਬਹੁਤ ਪੁਰਾਣਾ ਲੋਕ ਗੀਤ ਹੈ ਦੂ ਤੀਜਾ ਲੋਕ ਗੀਤ ਕੰਨਿਆ ਕਵਾਰੀ ਨੂੰ ਗਾਲ੍ਹ ਨਹੀਂ ਕੱਢੀ ਦੀ ਲੋਕਾਂ ਨੂੰ ਛੱਡੀ ਨਹੀਂ ਜਾਂਦੀ ਇਹ ਵੀ ਇੱਕ ਲੋਕ ਗੀਤ ਹੈ ਪਰ ਅੱਜ ਦੇ ਟਾਈਮ ਦੇ ਵਿੱਚ ਇਹਨਾਂ ਲੋਕ ਗੀਤਾਂ ਨੂੰ ਕੋਈ ਇੰਨੀ ਜ਼ਿਆਦਾ ਮਹੱਤਤਾ ਨਹੀਂ ਦਿੰਦਾ ਅੱਜ ਕੱਲ੍ਹ ਲੋਕ ਜ਼ਿਆਦਾਤਰ ਇੰਟਰਨੈਟ ਨੇ ਗਾਣਿਆਂ ਕਨੀ ਬੋਲੀਵੁੱਡ ਗਾਣਿਆਂ ਕਨੀ ਇੱਧਰ ਗਾਣਿਆਂ ਕਨੀ ਜ਼ਿਆਦਾ ਭੱਜ ਰਹੇ ਨੇ ਨਾ ਕਿ ਲੋਕ ਗੀਤਾਂ ਕਨੀ ਪਹਿਲਾਂ ਵਾਲੇ ਜ਼ਮਾਨੇ ਵਿੱਚ ਲੋਕ ਢੋਲਕੀ ਛੈਣਕਾ ਲੈ ਕੇ ਗੀਤ ਗਾਇਆ ਕਰਦੇ ਸੀ ਪਰ ਅੱਜ ਇਹ ਸਭ ਕੁਛ ਅਲੋਪ ਹੋ ਚੁੱਕਿਆ ਹੈ ਅਗਰ ਆਪਾਂ ਨੇ ਪੁਰਾਣੇ ਜ਼ਮਾਨੇ ਦੀ ਮਹੱਤਤਾ ਇਸ ਜ਼ਮਾਨੇ ਵਿੱਚ ਬਣਾਏ ਰੱਖਣੀ ਹੈ ਤਾਂ ਆਪਾਂ ਨੂੰ ਆਪਣੇ ਵਿਚਾਰ ਬਦਲਣੇ ਪੈਣਗੇ ਲੋਕ ਗੀਤਾਂ ਬਾਰੇ ਆਪਾਂ ਨੂੰ ਨਵੀਂ ਜਨਰੇਸ਼ਨ ਨੂੰ ਦੱਸਣਾ ਪਵੇਗਾ ਤਾਂ ਹੀ ਆਪਾਂ ਲੋਕ ਗੀਤਾਂ ਨੂੰ ਦੁਬਾਰਾ ਤੋਂ ਇਸ ਨਵੇਂ ਜ਼ਮਾਨੇ ਵਿੱਚ ਲਿਆ ਸਕਾਂਗੇ